ਹੈਲੋ ਐੱਚ ਆਰ ਢਾਬੇ ਤੋਂ ਬੋਲਦੇ ਜੀ ਮੈਂ ਨਰੇਸ਼ ਧੌਲ ਪੱਤਰਕਾਰ ਬੋਲ ਰਿਹਾਂ ਜੀ ਮੈਨੂੰ ਇੱਕ ਫੁੱਲ ਚਿਕਨ ਚਿੱਲੀ ਬਲਾਚੌਰ ਭੂਮਲਾ ਮੈਡੀਕਲ ਸਟੋਰ 'ਤੇ ਭੇਜ ਦਿੱਤੀ ਜਾਵੇ ਅਤੇ ਉਹਦੀ ਮੈਂ ਬਣਦੀ ਪੇਮੈਂਟ ਜਿਹੜਾ ਵੀ ਤੁਹਾਡਾ ਵਿਅਕਤੀ ਸਮਾਨ ਦੇਣ ਆਵੇਗਾ ਉਹਦੇ ਕੋਲ ਮੈਂ ਦੇ ਦੇਵਾਂਗਾ ਧੰਨਵਾਦ ਜੀ